ਹੈਲੋ ਤੁਸੀਂ ਸ਼ੋਪਕੀਪਰ ਹੋ ਸ਼ੋਪ ਅੱਛਾ ਤੁਹਾਡੇ ਕੋਲ ਟ੍ਰਡੀਸ਼ਨਲ ਕਲੌਥਸ ਹੈ ਅੱਛਾ ਕਿਹੜੇ ਕਿਹੜੇ ਹੈ ਦੱਸਿਓ ਅੱਛਾ ਅੱਛਾ ਅੱਛਾ ਜੀ ਅੱਛਾ ਬੱਚਿਆਂ ਵਾਸਤੇ ਸਾਰਾ ਕੁਛ ਉੱਥੇ ਮਿਲ ਜਾਂਦਾ ਹਸਬੈਂਡ ਵਾਸਤੇ ਵੀ ਸਾਡਾ ਸਾਰਾ ਕੁਛ ਕੁੜਤੇ ਪਜਾਮੇ ਸਾਰੇ ਕੁਛ ਹੈ ਪੱਗ ਪੱਗ ਹਾਂਜੀ ਆਹ ਲੇਡੀਜ਼ ਸੂਟ ਵਗੈਰਾ ਸਾਰੇ ਕੁਛ ਹੈ ਤੁਹਾਡੇ ਕੋਲ ਅੱਛਾ ਜੁੱਤੇ ਜੁੱਤੀਆਂ ਵੀ ਹੈਂ ਬੱਚਿਆਂ ਦੇ ਵੀ ਸਾਡੇ ਵੀ ਅਤੇ ਤੁਹਾਡਾ ਕੱਪੜਾ ਕਿੱਥੋਂ ਆਉਂਦਾ ਅੱਛਾ ਅੱਛਾ ਜਿੱਦਾਂ ਕਿ ਕੋਈ ਕੰਮਪਲੇਨ ਵਗੈਰਾ ਨਾ ਹੋਏ ਨਾ ਫਿਰ ਬਾਅਦ 'ਚ ਅੱਛਾ ਠੀਕ ਹੈ ਜੀ

ਕਿੱਥੇ ਹੈ ਤੁਹਾਡਾ ਸੋਪ ਅੱਛਾ ਅੱਛਾ ਤੁਸੀਂ ਮੈਨੂੰ ਆਪਣਾ ਲੌਕੇਸ਼ਨ ਭੇਜ ਦੋਂਗੇ ਵਟਸਐਪ 'ਤੇ ਠੀਕ ਇਹ ਮੇਰਾ ਇਹ ਠੀਕ ਹੈ ਇਹ ਨਾ ਇਹ ਮੇਰਾ ਵਾਸਟਐਪ ਨੰਬਰ ਹੈ ਤੁਸੀਂ ਆਪਣਾ ਲੌਕੇਸ਼ਨ ਪਲੀਸ ਭੇਜ ਦਿਓ ਮੈਨੂੰ ਹੈਂ ਅੱਛਾ ਠੀਕ ਹੈ ਮੈਂ ਨਾ ਉੱਥੇ ਆ ਕੇ ਫਿਰ ਵਿਜ਼ਿਟ ਕਰੂੰਗੀ ਠੀਕ ਹੈ ਜੀ ਓਕੇ ਅੱਛਾ ਫਿਰ ਠੀਕ ਹੈ ਮਤਲਬ ਪੱਗਾਂ ਪੁੱਗਾਂ ਸਭ ਕੁਛ ਮਤਲਬ ਜਿੱਦਾਂ ਕਿ ਕੁੜਤੇ ਪਜਾਮੇ ਦੇ ਪੈਂਟ ਸ਼ਰਟ ਸਾਰਾ

ਅੱਛਾ ਚੱਲੋ ਰੇਟ ਦਾ ਤਾਂ ਕੋਈ ਚੱਕਰ ਨਹੀਂ ਉਹ ਤਾਂ ਆਪਾਂ ਕਰ ਲਵਾਂਗੇ

ਠੀਕ ਹੈ ਜੀ ਓਕੇ ਜੀ